ਪੈਸੇ ਕਢਵਾਉਣ ਲਈ ਆਪਾਂ ਕਿਸੇ ਬੈਂਕਿੰਗ ਮੈਥਡ ਰਾਹੀਂ ਜਿਵੇਂ ਕਿ ਇੱਕ ਬਾਊਚਰ ਭ ਬਾਊਚਰ ਨਾਲ ਪੈਸਾ ਕਢਵਾਉਣ ਦੀ ਵਿਧੀ ਦਾ ਵਰਣਨ ਕਰਾਂਗੇ ਜਿਸ ਵਿੱਚ ਬਾਊਚਰ ਵਿੱਚ ਆਪਣਾ ਖਾਤਾ ਨੰਬਰ ਡੇਟ ਜਿੰਨੇ ਪੈਸੇ ਕਢਵਾਉਣੇ ਉਹ ਅਤੇ ਆਪਣੇ ਸਾਈਨ ਭਰ ਕੇ ਦੇਣ ਨਾਲ ਬੈਂਕ ਇਮਪਲੋਈ ਨੂੰ ਬਾਊਚਰ ਦੇ ਕੇ ਉਹਨਾਂ ਨੇ ਤੁਹਾਡੇ ਖਾਤੇ 'ਚੋਂ ਜਿੰਨੇ ਪੈਸਿਆਂ ਦਾ ਤੁਸੀਂ ਬਾਊਚਰ ਭਰਿਆ ਹੈ ਤੁਹਾਨੂੰ ਕਢਵਾ ਕੇ ਪੈਸੇ ਕੱਢ ਕੇ ਦੇਣਗੇ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਏ ਟੀ ਐੱਮ ਹੈ ਤਾਂ ਏ ਟੀ ਐੱਮ ਏ ਟੀ ਐੱਮ 'ਚ ਜਾ ਕੇ ਆਪਣਾ ਏ ਟੀ ਐੱਮ ਕ ਸਵਾਇਪ ਕਰਕੇ ਪਿੰਨਕੋਡ ਲਗਾ ਕੇ ਜਿੰਨੀ ਤੁਹਾਡੀ ਅਮਾਊਂਟ ਹੈ ਉਹਨੂੰ ਔਡਰ ਕਰਕੇ ਅਤੇ ਆਪਣਾ ਪਿੰਨਕੋਡ ਲਾ ਕੇ ਪੈਸੇ ਵੀ ਕਢਵਾ ਸਕਦੇ